ਕਿਸੇ ਵੀ ਸਮਾਨ ਦਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਭ ਤੋਂ ਪਹਿਲਾਂ ਇਹ ਦੇਖਣਾ ਪੈਂਦਾ ਹੈ ਕਿ ਇਸ ਦੀ ਡਿਮਾਂਡ ਸਾਡੇ ਕਸਬੇ ਜਾਂ ਸਾਡੇ ਸ਼ਹਿਰ ਦੇ ਵਿੱਚ ਕਿੰਨੀ ਕੁ ਹੈ ਔਰ ਇਹ ਸਮਾਨ ਸਾਨੂੰ ਕਿਹੜੀ ਮੰਡੀ ਤੋਂ ਲਿਆ ਕੇ ਇੱਥੇ ਵੇਚਣਾ ਪਏਗਾ ਉਹ ਜ਼ਰੀਆ ਕਿੰਨਾ ਕਿੱਥੋਂ ਦੂਰ ਹੈ ਉੱਥੋਂ ਇੱਥੇੇ ਲਿਆਉਣ ਦਾ ਕੀ ਖ਼ਰਚਾ ਆਵੇਗਾ ਜਿਸ ਦੇ ਨਾਲ ਸਾਡੀ ਲਾਗਤ ਮੁੱਲ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਨਹੀਂ ਹੋਵੇਗਾ ਅਤੇ ਅਸੀਂ ਜਾਇਜ਼ ਰੇਟ ਦੇ ਉੱਤੇ ਉਹ ਚੀਜ਼ਾਂ ਆਪਣੇ ਸਥਾਨ 'ਤੇ ਵੇਚ ਸਕਾਂਗੇ ਸਮਾਨ ਵੇਚਣ ਦੇ ਲਈ ਸਾਨੂੰ ਇੱਕ ਬਿਜ਼ਨਸ ਪਲੇਸ ਦੀ ਵੀ ਲੋੜ ਹੁੰਦੀ ਹੈ ਅਤੇ ਇਨਵੈਸਟਮੈਂਟ ਕਰਨ ਦੇ ਲਈ ਕਾਫ਼ੀ ਰਕਮ ਦੀ ਵੀ ਲੋੜ ਪੈਂਦੀ ਹੈ ਇਹ ਪੈਸਾ ਸਾਨੂੰ ਲੋਨ ਦੇ ਰੂਪ ਵਿੱਚ ਬੈਂਕਾਂ ਤੋਂ ਵੀ ਮਿਲ ਸਕਦਾ ਹੈ ਅਤੇ ਆਪਣੀਆਂ ਸੇਵਿੰਗਜ਼ ਵੀ ਸਾਨੂੰ ਯੂਜ ਕਰਨੀਆਂ ਪੈਂਦੀਆਂ ਹਨ ਭਾਰ ਤ ਭਾਰਤ ਦੇ ਕਾਰੋਬਾਰਾਂ ਨੂੰ ਸਮਰਥਨ ਦੇਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਹੁਤ ਹੀ ਘੱਟ ਇੰਟਰਸਟ 'ਤੇ ਛੋਟੇ ਲੈਵਲ ਦੇ ਕਾਰੋਬਾਰੀਆਂ ਨੂੰ ਜਿਹੜੀ ਇੱਕ ਰਕਮ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਨਵਾਂ ਬਿਜ਼ਨਸ ਆਰਾਮ ਦੇ ਨਾਲ ਸ਼ੁਰੂ ਕਰ ਸਕਣ ਆਪਣੇ